ਸਾਡੇ ਪਿੰਡ ਵਿੱਚ ਕੋਈ ਜਦੋਂ ਵੀ ਬਿਮਾਰ ਹੁੰਦਾ ਹੈ ਤਾਂ ਸਾਨੂੰ ਹੋਸਪਿਟਲ ਲਿਜਾਉਣ ਲਈ ਬੜੀ ਦਿੱਕਤ ਆਉਂਦੀ ਹੈ ਸਾਡੇ ਪਿੰਡ ਵਿੱਚ ਨਾ ਤਾਂ ਕੋਈ ਹੋਸਪਿਟਲ ਹੈ ਅਤੇ ਨਾ ਹੀ ਐਬੂਲੈਂਸ ਦੀ ਵਧੀਆ ਕੋਈ ਸੁਵਿਧਾ ਜਦੋਂ ਵੀ ਕੋਈ ਮਰੀਜ਼ ਬਿਮਾਰ ਹੁੰਦਾ ਹੈ ਅਸੀਂ ਐਬੂਲੈਂਸ ਵਾਲਿਆਂ ਨੂੰ ਫੋਨ ਕਰਦੇ ਹਾਂ ਤਾਂ ਉਹ ਲੇਟ ਪਹੁੰਚਦੇ ਹਨ ਕਿਉਂਕਿ ਸਾਡੇ ਪਿੰਡ ਵਿੱਚ ਆਉਣ ਵਾਲੇ ਰਸਤੇ ਬਹੁਤ ਹੀ ਜ਼ਿਆਦਾ ਖਰਾਬ ਹਨ ਜਿਸ ਕਾਰਨ ਐਬੂਲੈਂਸ ਸਾਡੇ ਪਿੰਡ ਬਹੁਤ ਲੇਟ ਪਹੁੰਚਦੀ ਹੈ ਕਿਉਂਕਿ ਰਸਤੇ ਵੀ ਖਰਾਬ ਹਨ ਅਤੇ ਸਾਡਾ ਪਿੰਡ ਵੀ ਸ਼ਹਿਰ ਤੋਂ ਕਾਫ਼ੀ ਦੂਰ ਪੈਂਦਾ ਹੈ ਇਸ ਲਈ ਐਬੂਲੈਂਸ ਦੀ ਸੁਵਿਧਾ ਸਾਨੂੰ ਬਹੁਤ ਹੀ ਘੱਟ ਮਿਲਦੀ ਹੈ ਅਤੇ ਹੋਸਪਿਟਲ ਵੀ ਸਾਡੇ ਤੋਂ ਜ਼ਿਆਦਾ ਦੂਰ ਹਨ ਇਸ ਲਈ ਐਬੂਲੈਂਸ ਨੂੰ ਆਉਣ ਵਿੱਚ ਵੀ ਟਾਈਮ ਜ਼ਿਆਦਾ ਲੱਗਦਾ ਹੈ ਅਤੇ ਨਾਲ ਸਾਨੂੰ ਕਨੈਕਟ ਉਹਨਾਂ ਨਾਲ ਕੋਂਟੈਕਟ ਕਰਨ ਵਿੱਚ ਵੀ ਜਾਂ ਕਨੈਕਟਿਵਿਟੀ ਵੀ ਸਾਨੂੰ ਬਹੁਤ ਘੱਟ ਜਾਂ ਖਰਾਬ ਮਿਲਦੀ ਹੈ ਜਿਸ ਕਾਰਨ ਐਬੂਲੈਂਸ ਵਾਲੇ ਜਾਂ ਤਾਂ ਉਹਨਾਂ ਨੂੰ ਕੋਲ ਨਹੀਂ ਲੱਗਦੀ ਜਾਂ ਫਿਰ ਉਹ ਜਦੋਂ ਆਉਂਦੇ ਹਨ ਤਾਂ ਰਸਤੇ ਖਰਾਬ ਜਾਂ ਟਰੈਫਿਕ ਕਾਰਨ ਉਹ ਇੱਥੇ ਲੇਟ ਪਹੁੰਚਦੇ ਹਨ